ਪੰਜਾਬੀ ਅਤੇ ਹਿੰਦੀ ਦੋਵੇਂ ਇੰਡੂ ਆਰੀਅਨ ਭਾਸ਼ਾਵਾਂ ਹਨ ਪਰ ਉਹਨਾਂ ਦੇ ਮੂਲ ਲਿਪੀ ਅਤੇ ਵਰਤੋਂ ਵਿੱਚ ਵੱਖਰੇ ਅੰਤਰ ਹਨ ਮੂਲ ਅਤੇ ਪ੍ਰਭਾਵ ਪੰਜਾਬੀ ਪੰਜਾਬ ਖੇਤਰ ਤੋਂ ਪੈਦਾ ਹੁੰਦਾ ਹੈ ਜੋ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡਿਆ ਹੋਇਆ ਹੈ ਇਸ ਦੀਆਂ ਜੜ੍ਹਾਂ ਪੰਜਾਬ ਦੇ ਇਤਿਹਾਸਿਕ ਖਿੱਤੇ ਵਿੱਚ ਡੂੰਘੀਆਂ ਗਈਆਂ ਹਨ ਅਤੇ ਇਸ ਖੇਤਰ ਦੇ ਵਿਭਿੰਨ ਇਤਿਹਾਸ ਕਾਰਨ ਇਹ ਵੱਖ ਵੱਖ ਭਾਸ਼ਾਵਾਂ ਦੁਆਰਾ ਪ੍ਰਭਾਵਿਤ ਹੋਇਆ ਹੈ ਜਿਸ ਵਿੱਚ ਫਾਰਸੀ ਅਰਬੀ ਅਤੇ ਤੁਰਕੀ ਸ਼ਾਮਿਲ ਹਨ ਹਿੰਦੀ ਮੁੱਖ ਤੌਰ 'ਤੇ ਉੱਤਰੀ ਅਤੇ ਮੱਧ ਭਾਰਤ ਵਿੱਚ ਬੋਲੀ ਜਾਂਦੀ ਹੈ ਇਹ ਸੰਸਕ੍ਰਿਤ ਤੋਂ ਪ੍ਰਕ੍ਰਿਤਿਕ ਅਤੇ ਫਰੈਂਚ ਭਾਸ਼ਾਵਾਂ ਰਾਹੀਂ ਵਿਕਸਿਤ ਹੋਇਆ ਹੈ ਅਤੇ ਭਾਰਤ ਵਿੱਚ ਇਤਿਹਾਸਿਕ ਮੁਸਲਮਾਨ ਸ਼ਾਸਨ ਦੇ ਕਾਰਨ ਫਾਰਸੀ ਅਰਬੀ ਅਤੇ ਤੁਰਕੀ ਭਾਸ਼ਾਵਾਂ ਦੁਆਰਾ ਪ੍ਰਭਾਵਿਤ ਹੋਇਆ ਹੈ ਸਕ੍ਰਿਪਟ ਪੰਜਾਬੀ ਭਾਰਤ ਵਿੱਚ ਗੁਰਮੁਖੀ ਲਿਪੀ ਵਿੱਚ ਅਤੇ ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ ਗੁਰਮੁਖੀ ਨੂੰ ਸੌਲਵੀਂ ਸਦੀ ਵਿੱਚ ਦੂਜੇ ਸਿੱਖ ਗੁਰੂ ਗੁਰੂ ਅੰਗਦ ਜੀ ਦੁਆਰਾ ਮਾਨਕੀਕਰਨ ਕੀਤਾ ਗਿਆ ਸੀ ਹਿੰਦੀ ਦੇਵਨਾਗਰੀ ਲਿਪੀ ਵਿੱਚ ਲਿਖੀ ਗਈ ਜੋ ਕਿ ਕਈ ਹੋਰ ਭਾਰਤੀ ਭਾਸ਼ਾਵਾਂ ਜਿਵੇਂ ਕਿ ਸੰਸਕ੍ਰਿਤ ਮਰਾਠੀ ਅਤੇ ਨੇਪਾਲੀ ਵਿੱਚ ਵੀ ਵਰਤੀ ਜਾਂਦੀ ਹੈ ਦੇਵਨਾਗਰੀ ਇੱਕ ਅਬੂ ਗੀੜਾ ਹੈ ਜਿੱਥੇ ਹਰੇਕ ਖ ਅੱਖਰ ਇੱਕ ਅੰਦਰੂਨੀ ਸਵਰਨ ਧੁਨੀ ਦੇ ਨਾਲ ਇੱਕ ਵਿਅੰਜਨ ਨੂੰ ਦਰਸਾਉਂਦਾ ਹੈ ਸੱਭਿਆਚਾਰਕ ਅਤੇ ਖੇਤਰੀ ਵਰਤੋਂ ਪੰਜਾਬੀ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਵਿਆਪਕ ਤੌਰ 'ਤੇ ਬੋਲੀ ਜਾਂਦੀ ਹੈ ਅਤੇ ਇਹ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਭਾਸ਼ਾ ਹੈ ਸਾਹਿਤ ਸੰਗੀਤ ਅਤੇ ਸਿਨੇਮਾ ਵਿੱਚ ਇੱਕ ਅਮੀਰ ਪਰੰਪਰਾ ਦੇ ਨਾਲ ਹਿੰਦੀ ਭਾਰਤ ਦੀਆਂ ਅਧਿਕਾਰਤ ਭਾਸ਼ਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ ਹਿੰਦੀ ਉੱਤਰੀ ਅਤੇ ਮੱਧ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਬੋਲੀ ਜਾਂਦੀ ਹੈ ਅਤੇ ਦੇਸ਼ ਦੇ ਅੰਦਰ ਵੱਖ ਵੱਖ ਭਾਸ਼ਾਵਾਂ ਦੇ ਬੋਲਣ ਵਾਲੀਆਂ ਵਿੱਚ ਸੰਚਾਰ ਲਈ ਇੱਕ ਭਾਸ਼ਾ ਫਰੈਂਕਾਂ ਵਜੋਂ ਕੰਮ ਕਰਦੀ ਹੈ ਸੰਖੇਪ ਵਿੱਚ ਜਦੋਂ ਕਿ ਦੋਵੇਂ ਭਾਸ਼ਾਵਾਂ ਆਪਣੀਆਂ ਸਾਂਝੀਆਂ ਇੰਡੋ ਆਰੀਅਨ ਜੜ੍ਹਾਂ ਕਾਰਨ ਕੁਝ ਸਮਾਨਤਾਵਾਂ ਸਾਂਝੀਆਂ ਕਰਦੀਆਂ ਹਨ ਉਹ ਆਪਣੀਆਂ ਲਿਪੀਆਂ ਧੁਨੀ ਵਿਗਿਆਨ ਅਤੇ ਸੱਭਿਆਚਾਰਕ ਸੁੰਦਰ ਬਾਂਹ ਵਿੱਚ ਮਹੱਤਵਪੂਰਨ ਤੌਰ 'ਤੇ ਭਿੰਨ ਹਨ